ਜਾਨਵਰਾਂ ਨੂੰ ਚਰਾਉਣ ਲਈ ਹਰੇ ਵਿਹੜੇ ਉਪਲਬਧ ਹਨ ਕਿਉਂਕਿ ਖੇਤਾਂ ਵਿੱਚ ਇਹਨਾਂ ਲਈ ਬਹੁਤ ਹੀ ਮੱਕੀ ਬੀਜੀ ਜਾਂਦੀ ਹੈ ਜੋ ਇਹਨਾਂ ਲਈ ਬਹੁਤ ਹੀ ਚੰਗੀ ਹੈ ਪਸ਼ੂਆਂ 'ਤੇ ਬੁਰਾ ਪ੍ਰਭਾਵ ਪੈਂਦਾ ਦੇਖਿਆ ਹੈ ਕਿਉਂਕਿ ਵਾਤਾਵਰਣ ਵਿੱਚ ਤਬਦੀਲੀ ਦੇ ਕਾਰਨ ਮੌਸਮ ਬਹੁਤ ਖਰਾਬ ਸੀ ਹੜ੍ਹ ਦੇ ਕਾਰਨ ਕਈ ਪਸ਼ੂਆਂ ਨੂੰ ਬਹੁਤ ਹੀ ਨੁਕਸਾਨ ਹੋਇਆ ਸੀ ਉਹਨਾਂ ਨੂੰ ਖਰਾਬ ਪਾਣੀ ਅਤੇ ਮੌਸਮ ਦੇ ਕਾਰਨ ਉਹਨਾਂ ਦੇ ਖਰਾਬ ਉਹਨਾਂ ਦਾ ਸਰੀਰ ਖਰਾਬ ਹੋ ਗਿਆ ਸੀ ਕਿਉਂਕਿ ਖਰਾਬ ਵਾਤਾਵਰਣ ਦੇ ਅਨੁਸਾਰ ਪਸ਼ੂਆਂ ਦੇ ਸਰੀਰ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਸੀ ਇਸ ਕਰਕੇ ਕਈ ਜਗ੍ਹਾ 'ਤੇ ਹੜ੍ਹ ਆਉਣ ਕਾਰਨ ਪਸ਼ੂਆਂ ਨੂੰ ਚੰਗਾ ਚਾਰਾ ਨਹੀਂ ਮਿਲਦਾ ਸੀ ਇਸ ਕਰਕੇ ਉਹ ਬਹੁਤ ਹੀ ਬਿਮਾਰ ਹੋ ਗਏ ਸਨ ਕਈ ਪਸੂ ਹੜ੍ਹ ਵਿੱਚ ਤੈਰ ਗਏ ਸੀ ਅਤੇ ਕਈ ਪਸ਼ੂ ਹੜ੍ਹ ਵਿੱਚ ਮਰ ਗਏ ਸਨ ਇਸ ਕਰਕੇ ਪਸ਼ੂਆਂ 'ਤੇ ਬੁਰਾ ਮੌਸਮ ਦਾ ਪ੍ਰਭਾਵ ਹੁੰਦਾ ਦੇਖਿਆ ਹੈ